ਦੋ ਹਜ਼ਾਰ ਤੇਈ ਦੀ ਗੱਲ ਸੀ ਜਦੋਂ ਮੈਂ ਪਹਿਲੀ ਵਾਰ ਕੁੱਲੂ ਗਿਆ ਸੀ ਜਿੱਥੇ ਮੈਂ ਕੁੱਲੂ ਦੇ ਇੱਕ ਨਗਰ ਸ਼ਹਿਰ ਵਿੱਚ ਗਿਆ ਸੀ ਜਿੱਥੇ ਮੈਂ ਮੇਰਾ ਦਸ ਦਿਨ ਦਾ ਕੈਂਪ ਸੀ ਉੱਥੇ ਅਤੇ ਉੱਥੇ ਅਸੀਂ ਬਹੁਤ ਅਤੇਉੱਥੇ ਅਸੀਂ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਆਪਣੇ ਦੋਸਤਾਂ ਨਾਲ ਅਤੇ ਟਰੈਕਿੰਗ ਕੀਤੀ ਅਸੀਂ ਉੱਥੇ ਜਾ ਕੇ ਨ ਅਤੇ ਸ਼ੋਪਿੰਗ ਕਰੀ ਥਾਂ ਥਾਂ ਘੁੰਮੇ ਮੰਦਰ ਗਏ ਅਤੇ ਕੁੱਲੂ ਦਿਖਣ ਨੂੰ ਕਾਫ਼ੀ ਸੋਹਣਾ ਸ਼ਹਿਰ ਹੈ ਜੇ ਜੇਕਰ ਮੈਨੂੰ ਦੁਬਾਰਾ ਮੌਕਾ ਮਿਲਦਾ ਹੈ ਮੈਂ ਉਸ ਥਾਂ ਦੁਬਾਰਾ ਜਾਣਾ ਪਸੰਦ ਕਰਾਂਗਾ ਕਿਉਂਕਿ ਉੱਥੇ ਤ ਉੱਥੇ ਦੀ ਯਾਦਾਂ ਮੇਰੇ ਮਨ 'ਤੇ ਹਜੇ ਵੀ ਸ਼ਾਮਲ ਹੈ ਅਤੇ ਉਸ ਤੋਂ ਬਾਅਦ ਕੁੱਲੂ ਦੇ ਬਾਅਦ ਅਸੀਂ ਕਾਂਗੜਾ ਗਏ ਸੀ ਕਾਂਗੜਾ ਵਿੱਚ ਅਸੀਂ ਲੇਕ 'ਤੇ ਨਹਾਏ ਅਤੇ ਕਾਫ਼ੀ ਜ਼ਿਆਦਾ ਇੰਜੋਏ ਕੀਤਾ ਦੋਸਤਾਂ ਨਾਲ ਅਤੇ ਉੱਥੇ ਅਸੀਂ ਇੱਕ ਧਰਮਸ਼ਾਲਾ ਵਿੱਚ ਵੀ ਰਹੇ ਜਿੱਥੇ ਸਾਨੂੰ ਕਾਫ਼ੀ ਮਜ਼ਾ ਆਇਆ ਅਤੇ ਮੇਰਾ ਮੰਨਣਾ ਇਹ ਹੈ ਕਿ ਇਨਸਾਨੀ ਜ਼ਿੰਦਗੀ ਵਿੱਚ ਇਹ ਜਿਹੀ ਯਾਦਾਂ ਦਾ ਹੋਣਾ ਕਾਫ਼ੀ ਜ਼ਰੂਰੀ ਹੈ ਤਾਂ ਕਿ ਉਹ ਆਪਣੇ ਇੱਕ ਸਮੇਂ ਬਾਅਦ ਇਹੋ ਜਿਹੇ ਪਲਾਂ ਨੂੰ ਯਾਦ ਕਰੇ ਅਤੇ ਸੋਚ ਕੇ ਖੁਸ਼ ਹੋਵੇ ਧੰਨਵਾਦ